ਖੇਡਾਂ ਖੇਡਣ ਲਈ ਸਾਡੇ ਕੋਲ ਗਰਾਊਂਡ ਬਹੁਤ ਵੱਡਾ ਹੈ ਅਤੇ ਖੇਡਾਂ ਖੇਡਣ ਲਈ ਉੱਥੇ ਬਹੁਤ ਵਧੀਆ ਜਗ੍ਹਾ ਹੈ ਇਸ ਲਈ ਉੱਥੇ ਪਾਣੀ ਦਾ ਖਾਣ ਪੀਣ ਦਾ ਵੀ ਬਹੁਤ ਪ੍ਰਬੰਧ ਹੈ ਅਤੇ ਖੇਡਾਂ ਕਰਨ ਲਈ ਸੁੱਕੀ ਜਗ੍ਹਾ ਵੀ ਹੋਣੀ ਬਹੁਤ ਜ਼ਰੂਰੀ ਹੈ ਇਸ ਲਈ ਅਸੀਂ ਖੇਡਾਂ ਖੇਡਦੇ ਹਾਂ